ਸਤਿ ਸ਼੍ਰੀ ਅਕਾਲ ਜੀ ਤੁਸੀਂ ਪੀ ਡਬਲਿਊ ਤੋਂ ਬੋਲ ਰਹੇ ਹੋ ਮੈਂ ਦੋ ਕੁ ਮਹੀਨੇ ਪਹਿਲਾਂ ਤੁਹਾਡੇ ਤੋਂ ਇੱਕ ਕੋਰਸ਼ ਮੰਗਵਾਇਆ ਸੀ ਗੇਟ ਦੀ ਤਿਆਰੀ ਲਈ ਜਿਹੜਾ ਕਿ ਮੈਨੂੰ ਬਹੁਤ ਪਸੰਦ ਆਇਆ ਉਹਦੇ ਵਿੱਚ ਓਨਲਾਈਨ ਕਲਾਸਾਂ ਕਿਤਾਬਾਂ ਅਤੇ ਹੈ ਨਾ ਸੋਲਵ ਕਰਨ ਦੇ ਲਈ ਡੀ ਪੀ ਪੀ ਵੀ ਦਿੱਤੀਆਂ ਜਾਂਦੀਆਂ ਨੇ ਜਿ ਜਿਹਨੂੰ ਦੇਖ ਕੇ ਮੈਨੂੰ ਹੀ ਬੜੀ ਅਚੰਭਾ ਹੋਇਆ ਕਿ ਐਨੇ ਘੱਟ ਰੇਟ ਦੇ ਵਿੱਚ ਐਨਾ ਵਧੀਆ ਮਟੀਰੀਅਲ ਤੁਸੀਂ ਪ੍ਰੋਵਾਈਡ ਕਰ ਰਹੇ ਹੋ ਅਤੇ ਇਹ ਮੈਂ ਦੇਖਿਆ ਹੈ ਕਿ ਐਨੇ ਘੱਟ ਦਾਮ ਦੇ ਵਿੱਚ ਹੋਰ ਕਿਤੇ ਵੀ ਇਹ ਉਪਲਬਧ ਨਹੀਂ ਹੈਗਾ ਅਤੇ ਜਿਸ ਕਰਕੇ ਮੈਨੂੰ ਮੈਂ ਤੁਹਾਡੇ ਇਸ ਪ੍ਰੋਡਕਟ ਦੇ ਨਾਲ਼ ਪੂਰਾ ਸੰਤੁਸ਼ਟ ਹਾਂ ਧੰਨਵਾਦ